ਕੀ ਤੁਸੀਂ ਫੋਟੋਗ੍ਰਾਫੀ ਨੂੰ ਇੱਕ ਪੇਸ਼ੇ ਵੱਜੋਂ ਲੈਣ ਬਾਰੇ ਸੋਚਿਆ ਸੀ ਨਹੀਂ ਮੈਨੂੰ ਫੋਟੋਗਰਾਫੀ ਇੱਕ ਪੇਸ਼ੇ ਵੱਜੋਂ ਲੈਣ ਬਾਰੇ ਮੈਨੂੰ ਨਹੀਂ ਵਧੀਆ ਲੱਗਦੀ ਮੈਨੂੰ ਫੋਟੋਗ੍ਰਾਫੀ ਪੇਸ਼ੇ ਵਜੋਂ ਨਹੀਂ ਮੈਂ ਲੈ ਸਕਦੀ ਕਿਉਂਕਿ ਮੈਨੂੰ ਇੱਕ ਸ਼ੌਂਕ ਹੈ ਫੋਟੋਗ੍ਰਾਫੀ ਦਾ ਅਤੇ ਅੱਜ ਕੱਲ੍ਹ ਵਿਆਹ ਦੀ ਫੋਟੋਗ੍ਰਾਫੀ ਬਾਰੇ ਕੀ ਸੋਚਦੇ ਹੋ ਵਿਆਹ ਦੀ ਫੋਟੋਗ੍ਰਾਫੀ ਅੱਜ ਕੱਲ੍ਹ ਵਿਆਹ ਦੇ ਵਿੱਚ ਵਿਆਵਾਂ ਦੇ ਵਿੱਚ ਫੋਟੋਗਰਾਫੀ ਬਾਰੇ ਮੈਂ ਇਹ ਸੋਚਦੀ ਹਾਂ ਕਿ ਵਿਆਵਾਂ ਦੇ ਵਿੱਚ ਅੱਜ ਕੱਲ੍ਹ ਕਿੰਨੀ ਜ਼ਿਆਦਾ ਫੋਟੋਆਂ ਖਿੱਚਣ ਲੱਗ ਪਏ ਹਨ ਜਦ ਕਿ ਇਸ ਨਾਲ ਸਮੇਂ ਦੀ ਪੈਸੇ ਦੀ ਕਿੰਨੀ ਜ਼ਿਆਦਾ ਬਰਬਾਦੀ ਹੋਣ ਲੱਗ ਪਈ ਹੈ ਅੱਜ ਦੇ ਸਮੇਂ ਦੇ ਵਿੱਚ ਜਦ ਕਿ ਪੁਰਾਣੇ ਸਮੇਂ ਵਿੱਚ ਉਹ ਥੋੜ੍ਹੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਸੀ ਅਤੇ ਉਹਨਾਂ ਦੀ ਇਕ ਐਲਬਮ ਬਣ ਜਾਂਦੀ ਸੀ ਜਿਹੜੀ ਕਿੰਨੇ ਕਿੰਨੇ ਸਾਲੋ ਸਾਲ ਕਿੱਥੇ ਖਰਾਬ ਨਹੀਂ ਹੁੰਦੀ ਸੀ ਅਤੇ ਆਰਾਮ ਨਾਲ ਦੇਖੀਆ ਜਾਂਦੀਆਂ ਸੀ ਜਦ ਕਿ ਅੱਜ ਦੇ ਟਾਈਮ ਦੇ ਵਿੱਚ ਫੋਟੋਆਂ ਹੀ ਕਲਿੱਕ ਕਰਦੇ ਰਹਿ ਜਾਂਦੇ ਨੇ ਔਰ ਕਿਸੇ ਕੋਲ ਇੰਨਾਂ ਸਮਾਂ ਹੀ ਨਹੀਂ ਹੈਗਾ ਕਿ ਫੋਟੋਆਂ ਦੇਖਣ ਅਤੇ ਐਲਬਮ ਕੱਢ ਕੇ ਦੇਖਣ ਜਾਂ ਡੀਵੀਡੀ ਸੀਡੀਆਂ ਮਤਲਬ ਬਣ ਜਾਂਦੀਆਂ ਹਨ ਅਤੇ ਉਹ ਚਲਾ ਚਲਾ ਕੇ ਦੇਖਣ ਇੰਨਾਂ ਸਮਾਂ ਹੀ ਨਹੀਂ ਹੁੰਦਾ ਪੁਰਾਣੇ ਸਮੇਂ ਦੀਆਂ ਫੋਟੋਆਂ ਅਤੇ ਐਲਬਮ ਦੇਖ ਕੇ ਮਜ਼ਾ ਵੀ ਆਉਂਦਾ ਸੀ ਸਾਰੇ ਘਰ ਦੇ ਇਕੱਠੇ ਹੋ ਜਾਂਦੇ ਹੁੰਦੇ ਸੀ ਅਤੇ ਕੱਢ ਕੱਢ ਕੇ ਆਪਣੀਆਂ ਐਲਬਮਾਂ ਯਾਦ ਕਰ ਕਰ ਕੇ ਫੋਟੋਆਂ ਦੇਖਦੇ ਹੁੰਦੇ ਸੀ ਅਤੇ ਅੱਜ ਦੇ ਟਾਈਮ ਵਿੱਚ ਤਾਂ ਕਿਸੇ ਕੋਲ ਸਮਾਂ ਹੀ ਨਹੀਂ ਹੈਗਾ ਇੰਨਾਂ ਕਿ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਖੋਲ੍ਹ ਕੇ ਦੇਖ ਸਕਣ ਅਤੇ ਇਸ ਨਾਲ ਅੱਜ ਦੇ ਟਾਈਮ ਵਿੱਚ ਫੋਟੋਗ੍ਰਾਫੀ ਵਿਆਹ ਸ਼ਾਦੀਆਂ 'ਚ ਇੰਨੀਆਂ ਫੋਟੋਆਂ ਖਿੱਚ ਕ ਖਿੱਚ ਲੈਂਦੇ ਆ ਕਿ ਇੰਨੀ ਪੈਸੇ ਦੀ ਬਰਬਾਦੀ ਕਰ ਦਿੰਦੇ ਆ ਕਿ ਅ ਅਗਲਾ ਲੈਣ ਬਾਰੇ ਵੀ ਪੰਜਾਹ ਵਾਰੀ ਸੋਚਦਾ ਹੈ ਕਿ ਮੈਂ ਇੰਨੀਆਂ ਪੈਸਾ ਖਰਚ ਕੇ ਐਲਬਮ ਲਵਾਂ ਨਾ ਲਵਾਂ